ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਫਾਰਮਰ ਆ ਜਿਵੇਂ ਕਿ ਕੁਛ ਕੁ ਫਾਰਮਰ ਹੁੰਦੇ ਜਿਹੜੇ ਅਮੀਰ ਹੁੰਦੇ ਆ ਅਤੇ ਉਹ ਜ਼ਿਆਦਾਤਰ ਆਪਣੀ ਜ਼ਮੀਨਾਂ ਦੇ ਵਿੱਚ ਮਸ਼ੀਨਾਂ ਯੂਜ ਕਰਕੇ ਕਿਹੜੀ ਆਪਣੀ ਫਸਲ ਵਗੈਰਾ ਹੁੰਦੀ ਆ ਉਹ ਵਧੀਆ ਉਗਾ ਲੈਂਦੇ ਆ ਪਰ ਕੁਛ ਕੁ ਜਿਹੜੇ ਫਾਰਮਰ ਹੁੰਦੇ ਉਹ ਗਰੀਬ ਹੁੰਦੇ ਆ ਅਤੇ ਉਹ ਜ਼ਿਆਦਾਤਰ ਦੇਸੀ ਤਰੀਕਿਆਂ ਨਾਲ ਹੀ ਫਾਰਮਿੰਗ ਕਰਦੇ ਆ ਪਰ ਕਿਹੜੇ ਵੱਡੇ ਫਾਰਮਰ ਹੁੰਦੇ ਆ ਉਹਨਾਂ ਦੀ ਜ਼ਿਆਦਤਰ ਅਨਾਜ ਵਿਕਨ ਨਹੀਂ ਦਿੰਦੇ ਅਤੇ ਉਹ ਅਲੱਗ ਅਲੱਗ ਮਸ਼ੀਨਾਂ ਯੂਜ ਕਰਕੇ ਆਪਣੀ ਕਿਹੜੀ ਉਹਨਾਂ ਦੀ ਦੇ ਜਲਦੀ ਦਿੰਦੇ ਕਿਹਦੇ ਕਰਕੇ ਜਿਹੜੇ ਛੋਟੇ ਕਿਸਾਨ ਹੁੰਦੇ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸੀਬਤਾਂ ਦਾ ਫੇਸ ਕਰਨਾ ਪੈਂਦਾ ਏ